ਹਰਿਆ ਭਰਿਆ ਅਤੇ ਸਾਫ ਵਾਤਾਵਰਨ ਦੀ ਰੱਖਿਆ ਲਈ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਬੂਟੇ ਲਾਉਣੇ ਚਾਹੀਦੇ ਹੈ ਸਾਨੂੰ ਗੱਡੀਆਂ 'ਤੇ ਨਹੀਂ ਪੈਦਲ ਜਾਣਾ ਚਾਹੀਦਾ ਹੈ ਕਿਉਂਕਿ ਗੱਡੀਆਂ ਨਾਲ ਬਹੁਤ ਜ਼ਿਆਦਾ ਪ੍ਰਦੂਸ਼ਣ ਹੁੰਦਾ ਹੈ ਅਤੇ ਪ੍ਰਦੂਸ਼ਣ ਕਈ ਪ੍ਰਕਾਰ ਦਾ ਹੁੰਦਾ ਹੈ ਜਿੱਦਾਂ ਹਵਾ ਪ੍ਰਦੂਸ਼ਣ ਜਲ ਪ੍ਰਦੂਸ਼ਣ ਅਤੇ ਆਵਾਜ਼ ਦਾ ਪ੍ਰਦੂਸ਼ਣ ਜਿੱਦਾਂ ਗੱਡੀਆਂ ਵਿੱਚ ਹੋਰਨ ਮਾਰ ਮਾਰ ਕੇ ਆਵਾਜ਼ ਪ੍ਰਦੂਸ਼ਣ ਹੁੰਦਾ ਹੈ ਅਤੇ ਵੱਡੇ ਲੋਕ ਡੀ ਜੇ ਲਾ ਲਾ ਕੇ ਆਵਾਜ਼ ਪ੍ਰਦੂਸ਼ਣ ਕਰਦੇ ਹਨ ਅਤੇ ਜਲ ਪ੍ਰਦੂਸ਼ਣ ਲੋਕ ਫੈਕਟਰੀਆਂ ਬਣਾ ਬਣਾ ਕੇ ਜਲ ਨੂੰ ਪ੍ਰਦੂਸ਼ਣ ਕਰਦੇ ਹਨ ਅਤੇ ਗਡ ਗੱਡੀਆਂ ਚਲਾ ਚਲਾ ਕੇ ਹਵਾ ਦਾ ਪ੍ਰਦੂਸ਼ਣ ਹੁੰਦਾ ਹੈ ਅਤੇ ਕਈ ਲੋਕ ਕੱਪੜੇ ਧੋ ਧੋ ਕੇ ਜਲ ਪ੍ਰਦੂਸ਼ਣ ਵੀ ਕਰਦੇ ਹਨ